ਖੇਤੀ ਰੂਪਨਗਰ ਦੇ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਦਾ ਮੁੱਖ ਕਿੱਤਾ ਹੈ ਅਤੇ ਇੱਥੋਂ ਦੇ ਲੋਕ ਖੇਤੀ ਨੂੰ ਬੜੇ ਸੁਚਾਰੂ ਅਤੇ ਤਕਨੀਕੀ ਤਰੀਕੇ ਢੰਗ ਨਾਲ ਕਰਦੇ ਹਨ ਇਹ ਕਿੱਤਾ ਆਰਥਿਕ ਤੌਰ 'ਤੇ ਕਾਫੀ ਲਾਹੇਵੰਦ ਹੈ ਜੇਕਰ ਅਸੀਂ ਹੱਥੀਂ ਕੰਮ ਜੇਕਰ ਅਸੀਂ ਇਸ ਕਿੱਤੇ ਵਿੱਚ ਹੱਥੀਂ ਕੰਮ ਕਰੀਏ ਤਾਂ ਸਾਨੂੰ ਇਹ ਸਾਡੀ ਆਮਦਨ ਦਾ ਇੱਕ ਵਧੀਆ ਸਾਧਨ ਹਨ ਅਤੇ ਸਾਨੂੰ ਇਸ ਕਿੱਤੇ ਰਾਹੀਂ ਬਹੁਤ ਕੁਝ ਨਵੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ ਹਨ ਅਤੇ ਅਸੀਂ ਅੰਨਦਾਤੇ ਵੱਜੋਂ ਵੀ ਇਸ ਕਿੱਤੇ ਨਾਲ ਜਾਣੇ ਜਾ ਸਕਦੇ ਹਾਂ